ਮੈਂ ਅੱਜ ਸਮਕਾਲੀ ਗੀਤ ਗਾਉਣ ਵਿੱਚ ਲੱਗਿਆ ਹਾਂ ਠੀਕ ਹੈ ਮੈਂ ਸ਼ਾਸ਼ਤਰੀ ਗੀਤ ਨਹੀਂ ਮੈਂ ਸ਼ਾਸਤੀ ਗੀਤ ਕ ਨਹੀਂ ਗਾ ਸਕਦਾ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਅਤੇ ਠੀਕ ਹੈ ਮੈਂ ਸਮਕਾਲੀ ਗੀਤ ਗਾਉਣਾ ਪਸੰਦ ਕਰਦਾ ਹਾਂ ਠੀਕ ਹੈ ਸਾਨੂੰ ਸ਼ਾਸਤਰੀ ਗੀਤ ਗਾਉਣ ਵਿੱਚ ਸਾਨੂੰ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ ਲੋ ਸ ਇਹ ਸਮਝਣਾ ਔਖਾ ਹੈ ਅਤੇ ਗਾਉਣਾ ਔਖਾ ਹੈ ਇਸ ਵਿੱਚ ਬਹੁਤ ਸਾਰੀਆਂ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ ਸ਼ਾਸਤਰੀ ਗੀਤ ਵਿੱਚ ਠੀਕ ਹੈ ਜਿਵੇਂ ਇਹ ਜਿਵੇਂ ਕਿ ਮੈਂ ਸਮਕਾਲੀ ਗੀਤ ਗਾਉਂਦਾ ਹਾਂ ਅਤੇ ਉਸ ਤੋਂ ਬਾਅਦ ਇਸ ਲਈ ਇਹਨੂੰ ਕਿਸੇ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਗਾਣੇ ਆ ਚੁੱਕੇ ਹਨ ਠੀਕ ਹੈ ਇਸ ਲਈ ਸ਼ ਇਹ ਸ਼ਾਸਤਰੀ ਗੀਤ ਗਾਉਣਾ ਬਹੁਤ ਔਖਾ ਏ ਗਾਉਣਾ ਅਤੇ ਸਮਝਣਾ ਬਹੁਤ ਜ਼ਿਆਦਾ ਹੀ ਔਖਾ ਏ ਇਸ ਵਿੱਚ ਬਹੁਤ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ ਸਾਨੂੰ